ਇੱਕ ਨਵਜੰਮੇ ਬੱਚੇ ਵਾਸਤੇ ਅਸੀਂ ਇੱਦਾਂ ਕਰਦੇ ਹਾਂ ਕਿ ਉਹਨੂੰ ਪਹਿਲਾਂ ਤਾਂ ਐਨ ਸਾਫ ਸੁਥਰਾ ਮਾਹੌਲ ਦੇਈਏ ਤਾਂ ਕਿ ਉਹਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਅਤੇ ਵਾਰ ਵਾਰ ਉਸ ਬੱਚੇ ਨੂੰ ਆਪਾਂ ਹੱਥ ਨਾ ਲਗਾਈਏ ਕਿ ਉਹ ਹਰੇਕ ਤਰ੍ਹਾਂ ਦੇ ਜਿਹੜੇ ਵਾਇਰਸ ਆ ਉਸ ਬੱਚੇ ਨੂੰ ਨਾ ਲੱਗ ਸਕਣ ਔਰ ਰਹੀ ਗੱਲ ਉਸ ਬੱਚੇ ਨੂੰ ਅਸੀਂ ਅੱਛੇ ਕੱਪੜੇ ਪਾਈਏ ਔਰ ਸਾਫ ਸੁਥਰਾ ਰੱਖੀਏ ਤਾਂ ਕਿ ਉਹਦੇ ਤੱਕ ਕੋਈ ਵੀ ਕੀਟਾਣੂ ਜਿਹੜੇ ਨਾ ਲੱਗ ਸਕਣ ਜਦ ਬੱਚਾ ਛੇ ਮਹੀਨੇ ਦਾ ਹੋ ਜਾਂਦਾ ਹੈ ਉਹਨੂੰ ਅਸੀਂ ਥੋੜ੍ਹੇ ਲਿਕੂਅਡ ਜਾਂ ਦਾਲਾਂ ਜਾਂ ਕੁਛ ਫਰੂਟ ਦੇ ਸਕੀਏ ਖਾਣ ਨੂੰ ਹੈ ਨਾ ਅਤੇ ਵੀ ਉਹ ਚੰਗੀ ਤਰ੍ਹਾਂ ਰਹਿ ਸਕਣ ਉਹਨਾਂ ਦੀ ਹੈਲਥ ਵਧੀਆ ਹੋ ਜਾਵੇ ਬੱਚੇ ਦੀ ਫਿਰ ਜਦੋਂ ਬੱਚਾ ਥੋੜ੍ਹਾ ਜਿਹਾ ਤੁਰਨ ਫਿਰਨ ਵਾਲਾ ਹੋ ਜਾਵੇ ਉਹਦੀ ਅੱਛੀ ਤਰ੍ਹਾਂ ਮਾਲਿਸ਼ ਕਰਨੀ ਸ਼ੁਰੂ ਕਰ ਦੇਈਏ ਜਦਕਿ ਉਹਦੀਆਂ ਹੱਡੀਆਂ ਮਜ਼ਬੂਤ ਹੋ ਜਾਣ ਜਿਸ ਨਾਲ ਉਹ ਆਪਣੀਆਂ ਲੱਤਾਂ 'ਤੇ ਭਾਰ ਲੈ ਸਕੇ ਅਤੇ ਵਧੀਆ ਢੰਗ ਨਾਲ ਹੈਲਥੀ ਹੋ ਸਕੇ ਔਰ ਚੱਲ ਫਿਰ ਸਕੇ ਨਾ ਕਿ ਉਹ ਬਿਮਾਰ ਹੋਵੇ ਨਾ ਹੀ ਉਹ ਕੋਈ ਪ੍ਰੋਬਲਮ 'ਚ ਪਵੇ ਅਤੇ ਦਵਾਈਆਂ ਦਾ ਘੱਟ ਤੋਂ ਘੱਟ ਅਸੀਂ ਯੂਜ਼ ਕਰੀਏ